ਹਾਂਜੀ ਗੁਡ ਆਫਟਰਨੂਨ ਸਰ ਹਾਂਜੀ ਸਰ ਮੈਨੂੰ ਤੁਹਾਡਾ ਨੰਬਰ ਨਾ ਮੇਰੇ ਆਪਣੇ ਇੱਕ ਫਰੈਂਡ ਤੋਂ ਮਿਲਿਆ ਜੀ ਅਤੇ ਉਹਨਾਂ ਨੇ ਤੁਹਾਡੀ ਕੰਪਨੀ ਦੇ ਥਰੂ ਪਲੇਸਮੈਂਟ ਲਈ ਹੈ ਅਤੇ ਉਸ ਦੇ ਥਰੂ ਹੀ ਮੈਂ ਮੈਂ ਵੀ ਇਹ ਚਾਹੁੰਦਾ ਕਿ ਮੈਂ ਪਲੇਸਮੈਂਟ ਦੇ ਲਈ ਅਪਲਾਈ ਕਰਾਂ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡੀ ਕੰਪਨੀ ਦੇ ਵਿੱਚ ਕਿਹੜੀ ਕਿਹੜੀ ਓਪੋਰਚੁਨਿਟੀਜ ਹੈ ਜਿਹੜੀ ਜੀ ਮੈਂ ਐਸ ਐਸ ਸੀ ਇਨ ਕਮਿਸਟਰੀ ਕਰੀ ਹੈ ਜੀ ਅਤੇ ਆਪਣਾ ਇਹ ਇਹ ਆਪਣਾ ਡੀ ਏ ਵੀ ਕੋਲੇਜ ਤੋਂ ਜੀ ਚੰਡੀਗੜ੍ਹ ਤੋਂ ਆਹਾ ਆਪਣਾ ਦਸ ਸੈਕਟਰ ਜੀ

ਹਾਂਜੀ ਮੈਂ ਟੂ ਥਾਊਂਸਡ ਟਵੈਂਨਟੀ ਵੰਨ ਦਾ ਪਾਸਡ ਆਉਟ ਆ ਸਰ ਹਾਂਜੀ ਸਰ ਉ ਉਸ ਟਾਈਮ ਉਸ ਟਾਈਮ ਜਦ ਪਲੇਸਮੈਂਟ ਆਈਆਂ ਸੀ ਜੀ ਜੀ ਉਸ ਟਾਈਮ ਮੈਂ ਬੈਠਿਆ ਨਹੀਂ ਪਲੇਸਮੈਂਟ ਦੇ ਵਿੱਚ ਉਸ ਟਾਈਮ ਮੈਂ ਗੋਰਮੈਂਟ ਜੋਬ ਦੀ ਤਿਆਰੀ ਕਰਦਾ ਪਿਆ ਸੀ ਜੀ ਜੀ ਓਕੇ ਜੀ ਜੀ

ਜੀ ਇਹ ਤਾਂ ਬਹੁਤ ਵਧੀਆ ਜੀ

ਅੱਛਾ ਜੀ ਮੈਂ ਸੋਚ ਰਿਹਾ ਸੀਗਾ ਕਿ ਹਾਂਜੀ ਟੀਚਿੰਗ ਬਾਰੇ

ਜੀ ਅੱਛਾ ਜੀ

ਜੀ ਮੇਰੇ ਸੈਵੇਨਟੀ ਪਲਸ ਹੈ ਜੀ ਮਾਰਕਸ ਉਹਦੇ ਜੀ ਜੀ ਤੁਸੀਂ ਆਪਣੇ ਥਰੂ ਵੀ ਰਿਕਰੂਟਮੈਂਟ ਕਰਵਾਉਂਦੇ ਹੋ

ਚਲੋ ਠੀਕ ਹੈ ਸਰ ਫਿਰ ਮੈਂ ਡਿਸਾਈਡ ਕਰਕੇ ਫਿਰ ਤੁਹਾਨੂੰ ਕਾਲ ਕਰਦਾ ਜੀ ਓਕੇ